ਅਚਾਰ ਅਚਾਰ ਬਹੁਤ ਤਰ੍ਹਾਂ ਦੇ ਹੁੰਦੇ ਹੈ ਜਿਵੇਂ ਕਿ ਨਿੰਬੂ ਦਾ ਅਚਾਰ ਹੋ ਗਿਆ ਅੰਬ ਦਾ ਅਚਾਰ ਹੋ ਗਿਆ ਗਾਜਰਾਂ ਦਾ ਅਚਾਰ ਹੋ ਗਿਆ ਇਸ ਲਈ ਆਪਾਂ ਪਹਿਲਾਂ ਅਚਾਰ ਦੀ ਗੱਲ ਕਰੀਏ ਜਿਵੇਂ ਕਿ ਗਾਜਰਾਂ ਦਾ ਅਚਾਰ ਹੋ ਗਿਆ ਪਹਿਲਾਂ ਆਪਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਧੌਂਦੇ ਹਾਂ ਫਿਰ ਉਨ੍ਹਾਂ ਦੇ ਛਿਲਕੇ ਉਤਾਰਦੇ ਹਾਂ ਫਿਰ ਉਨ੍ਹਾਂ ਨੂੰ ਬਰੀਕ ਬਰੀਕ ਕੱਟ ਕੇ ਉਹਦੇ ਵਿੱਚ ਤੇਲ ਪਾ ਕੇ ਉਹਦੇ ਵਿੱਚ ਨਮਕ ਮਿਰਚ ਆਪਣੇ ਅਕੋਡਿੰਗ ਜਾਂ ਆਪਣੇ ਸੁਆਦ ਅਨੁਸਾਰ ਆਪਾਂ ਕੁਛ ਵੀ ਹੋਰ ਡਾਲ ਸਕਦੇ ਜਿਵੇਂ ਕਾਲੀ ਮਿਰਚ ਕਾਲਾ ਨਮਕ ਇਹ ਸਾਰਾ ਕੁਛ ਡਾਲ ਸਕਦੇ ਹਾਂ ਐਵੇਂ ਅਚਾਰ ਬਣਦਾ ਓਵੇਂ ਹੀ ਨਿੰਬੂ ਦਾ ਅਚਾਰ ਬਣਦਾ ਨਿੰਬੂ ਨੂੰ ਪਹਿਲਾਂ ਕੱਟ ਲੈਂਦੇ ਹੈ ਕਈ ਲੋਕ ਉਹਨੂੰ ਪਹਿਲਾਂ ਉਬਾਲ ਕੇ ਫਿਰ ਉਹਨੂੰ ਕੱਟ ਕੇ ਉਹਨੂੰ ਸਾਰੇ ਮਸਾਲੇ ਵਿੱਚ ਪਾ ਦਿੰਦੇ ਹੈ ਤਾਂ ਇਹਦੇ ਨਾਲ ਇਹ ਬਹੁਤ ਜ਼ਿਆਦਾ ਸੁਆਦ ਬਣ ਜਾਂਦਾ ਨਿੰਬੂ ਅਚਾਰ ਖਾਣ ਦੇ ਬਹੁਤ ਮਹੱਤਤਾ ਹੁੰਦੀ ਹੈ ਮਤਲਬ ਬਹੁਤ ਬੈਨੀਫਿੱਟ ਹੁੰਦੇ ਆਪਾਂ ਨੂੰ ਇਹਦੇ ਨਾਲ ਸਭ ਤੋਂ ਬੈਨੀਫਿੱਟ ਇਹ ਹੈ ਵੀ ਜਦੋਂ ਆਪਾਂ ਰੋਟੀ ਨਾਲ ਅਚਾਰ ਖਾਂਦੇ ਹਾਂ ਤਾਂ ਆਪਾਂ ਨੂੰ ਰੋਟੀ ਜਿਹੜੀ ਕਿ ਡੀਜੈਸਟ ਹੋ ਜਾਂਦੀ ਹੈ ਹਜ਼ਮ ਹੋ ਜਾਂਦੀ ਹੈ ਅਤੇ ਆਪਾਂ ਨੂੰ ਪੇਟ ਦੀਆਂ ਕਈ ਬਿਮਾਰੀਆਂ ਆਉਂਦੀਆਂ ਉਹ ਦੂਰ ਹੋ ਜਾਂਦੀਆਂ ਪੇਟ ਸਾਫ਼ ਹੋ ਜਾਂਦਾ ਤਾਂ ਆਪਾਂ ਨੂੰ ਇਸ ਦੀਆਂ ਬਹੁਤ ਸਾਰੇ ਫਾਇਦੇ ਮਿਲਦੇ ਹੈ ਕਈ ਲੋਕ ਅਚਾਰ ਨਾਲ ਹੀ ਰੋਟੀ ਖਾਣਾ ਜ਼ਿਆਦਾ ਪਸੰਦ ਕਰਦੇ ਹੈ ਸਬਜ਼ੀ ਦੀ ਬਜਾਏ ਕਿਉਂਕਿ ਅਚਾਰ ਦੇ ਬਹੁਤ ਫਾਇਦੇ ਹੈ ਪੁਰਾਣੇ ਟਾਈਮ ਵਿੱਚ ਲੋਕ ਬਹੁਤ ਜ਼ਿਆਦਾ ਤੋਂ ਜ਼ਿਆਦਾ ਅਚਾਰ ਖਾਂਦੇ ਸੀ ਜਿਹਦੇ ਨਾਲ ਕਿ ਉਨ੍ਹਾਂ ਦਾ ਸਰੀਰ ਜਿਹੜਾ ਕਿ ਸਹੀ ਰਹਿੰਦਾ ਸੀ